ਰੋਪੜ ਜ਼ਿਲ੍ਹੇ ਵਿੱਚ ਮੁੱਖ ਸਮਾਜ ਭਲਾਈ ਅਤੇ ਵਿਕਾਸ ਪ੍ਰੋਗਰਾਮਾਂ ਅਤੇ ਪਹਿਲਕਦਮੀ ਜਿਵੇਂ ਕਿ ਕਿਸੇ ਕੁੜੀ ਦਾ ਵਿਆਹ ਕਰਨਾ ਅਤੇ ਉਹਦੇ ਲਈ ਕੁਛ ਸਹੂਲਤਾਂ ਚਾਹੀਦੀਆਂ ਹਨ ਜੋ ਗਰੀਬ ਪਰਿਵਾਰ ਨਹੀਂ ਕਰ ਸਕਦਾ ਤਾਂ ਉਹਦੇ ਲਈ ਉਹ ਸਹੂਲਤਾਂ ਭੇਜ ਦੇਣੀਆਂ ਚਾਹੀਦੀਆਂ ਤਾਂ ਉਹ ਗਰੀਬ ਪਰਿਵਾਰ ਆਪਣੀ ਕੁੜੀ ਦਾ ਵਿਆਹ ਕਿਸੇ ਸਹੀ ਢੰਗ ਨਾਲ ਕਰ ਲਵੇ ਤਾਂ ਨਾ ਕਿ ਉਹਦੇ ਦਿਮਾਗ ਪਰ ਕੋਈ ਬੋਝ ਭਾਰ ਪਵੇ ਤਾਂ ਸਹੀ ਤਰੀਕੇ ਨਾਲ ਉਹ ਆਪਣੀ ਧੀ ਦਾ ਵਿਆਹ ਕਰ ਲਵੇ ਨਾ ਉਹਦੇ ਸਿਰ ਪਰ ਕੋਈ ਕਰਜ਼ਾ ਚੜ੍ਹੇ ਇਹ ਜ ਇਸ ਤਰੀਕੇ ਦੀ ਸਹੂਲਤ ਚਾਹੀਦੀ ਆ ਦੂਸਰਾ ਪੜ੍ਹਾਈ ਹੋ ਗਈ ਪੜ੍ਹਾਈ ਇੱਥੇ ਰੋਪੜ ਜ਼ਿਲ੍ਹੇ ਵਿੱਚ ਕੋਈ ਵਧੀਆ ਤਰ੍ਹਾਂ ਦੇ ਕੋਰਸ ਇਸ ਤਰੀਕੇ ਦੇ ਲੈ ਕੇ ਆਉਣ ਜਿੱਕਣਾ ਕਿ ਬੜੇ ਸ਼ਹਿਰਾਂ ਦੇ ਵੇਿੱਚ ਬੜੀਆਂ ਸਿਟੀਆਂ ਦੇ ਵਿੱਚ ਹੋਵੇ ਤਾਂ ਉੱਦਾਂ ਦੇ ਕੋਰਸ ਆਉਣੇ ਚਾਹੀਦੇ ਆ ਦੂਸਰਾ ਨੰਬਰ ਰੁਜ਼ਗਾਰ ਰੁਜ਼ਗਾਰ ਨੂੰ ਲੈ ਕੇ ਲੋਕ ਕਾਫੀ ਜ਼ਿਆਦਾ ਤੰਗ ਨੇ ਇੱਥੇ ਕੋਈ ਨਾ ਕੋਈ ਫੈਕਟਰੀ ਵਗੈਰਾ ਖੁੱਲ੍ਹਣੀ ਚਾਹੀਦੀ ਆ ਜਿੱਥੇ ਲੋਕ ਆਪਣਾ ਘਰ ਦਾ ਖਰਚਾ ਚਲਾ ਸਕਣ ਆਪਣਾ ਪਰਿਵਾਰ ਪਾਲ ਸਕਣ ਅਤੇ ਦੂਸਰਾ ਆਪਣੀ ਗਰੀਬੀ ਨੂੰ ਚੱਕ ਸਕਣ ਆਪਣੇ ਬੱਚਿਆਂ ਨੂੰ ਚੰਗੇ ਤਰੀਕੇ ਨਾਲ ਪੜ੍ਹਾ ਸਕਣ ਜਾਂ ਕਿ ਬੱਚਿਆਂ ਨੂੰ ਉਹਨਾਂ ਨੂੰ ਅੱਗੇ ਆਉਣ ਦੇ ਸਮੇਂ ਤੱਕ ਕੋਈ ਦਿੱਕਤਬਾਜ਼ੀ ਨਾ ਆਵੇ